ਸਾਡੀ ਰੋਟੀ ਰੋਜ਼ੀ ਜਿਹੜੀ ਉਹ ਬਿਜਲੀ 'ਤੇ ਨਿਰਭਰ ਹੈ ਜਦੋਂ ਬਿਜਲੀ ਚਲੀ ਜਾਂਦੀ ਹੈ ਸਾਨੂੰ ਬਹੁਤ ਦਿੱਕਤ ਆਉਂਦੀ ਹੈ ਬਿਜਲੀ ਦੇ ਕੱਟਾਂ ਦੌਰਾਨ ਨਾ ਸਾਡਾ ਸਮਾਨ ਬਹੁਤ ਹੀ ਖ਼ਰਾਬ ਹੁੰਦਾ ਜਿਵੇਂ ਕਿ ਦਹੀਂ ਚੋਕਲੇਟ ਦੁੱਧ ਔਰ ਵਗੈਰਾ ਹੁੰਦੇ ਹਨ ਬਿਜਲੀ ਦੇ ਕੱਟਾਂ ਵਿੱਚ ਰੋਸ਼ਨ ਲਈ ਸਾਨੂੰ ਬਿਜਲੀ ਦੀ ਜਦੋਂ ਕੱਟ ਲੱਗ ਜਾਂਦੇ ਸਾਨੂੰ ਬਹੁਤ ਹੀ ਤਕਲੀਫ ਆਉਂਦੀ ਹੈ ਸਾਡੀ ਰੋਜ਼ੀ ਰੋਟੀ ਇਸੇ 'ਤੇ ਨਿਰਭਰ ਕਰਦੀ ਹੈ ਅਤੇ ਸਾਨੂੰ ਇਸਦੀ ਬਿਜਲੀ ਦੀ ਬਹੁਤ ਜ਼ਰੂਰਤ ਹੁੰਦੀ ਹੈ ਜਦੋਂ ਕੱਟ ਲੱਗ ਜਾਣ ਤਾਂ ਬਹੁਤ ਦੁੱਖ ਤਕਲੀਫ ਆਉਂਦੀ ਹੈ ਅਤੇ ਸਾਡਾ ਸਮਾਨ ਵੀ ਬਹੁਤ ਖ਼ਰਾਬ ਹੁੰਦਾ ਹੈ ਰੋਜ਼ੀ ਲਈ ਇਸ ਲਈ ਸਾਨੂੰ ਬਿਜਲੀ ਦੇ ਕੱਟਾਂ ਵਿੱਚ ਬਹੁਤ ਔਖਾ ਹੁੰਦਾ ਹੈ ਇਸ ਕਰਕੇ ਸਾਨੂੰ ਬਿਜਲੀ ਦੀ ਜ਼ਰੂਰਤ ਹੈ ਤਾਂ ਕਿ ਸਾਡਾ ਸਮਾਨ ਨਾ ਖ਼ਰਾਬ ਹੋਵੇ ਜਿਵੇਂ ਐਸਕ੍ਰੀਮ ਦੁੱਧ ਦਹੀਂ ਚੋਕਲੇਟ ਠੰਡੇ ਕੋਕ ਕ ਕੋ ਠੰਡੇ ਜਿਵੇਂ ਐਸ ਕੋਕੋਨਟ ਉਹ ਸਭ ਚੀਜ਼ਾਂ ਤੋਂ ਪ੍ਰਭਾਵਿਤ ਕਰਦੀ ਹੈ ਇੱਥੇ ਲੋਕਾਂ ਕੋਲ ਇਨਵੈਟਰ ਹਨ ਉਹ ਇਨਵੈਟਰ ਨਾਲ ਹੀ ਆਪਣਾ ਕੰਮ ਕਾਰ ਚਲਾਉਂਦੇ ਹਨ ਇਨਵੈਟਰ ਨਾਲ ਹੀ ਆਪਣੇ ਟਾਈਮ ਪਾਸ ਕਰਦੇ ਹਨ ਬਿਜਲੀ ਜਾਣ ਨਾਲ ਇੱਥੇ ਇਨਵੈਟਰ ਹੀ ਵਰਤਣਾ ਪੈਂਦਾ ਹੈ ਇਸ ਕਰਕੇ ਸਾਨੂੰ ਬਿਜਲੀ ਦੇ ਕੱਟਾਂ ਦੀ ਬਹੁਤ ਔਖਿਆਈ ਆਉਂਦੀ ਹੈ ਅਤੇ ਇਨਵੈਟਰ ਹੀ ਵਰਤਣੇ ਪੈਂਦਾ ਹੈ ਇਸ ਕਰਕੇ ਸਾਨੂੰ ਬਿਜਲੀ ਦੀ ਜ਼ਰੂਰਤ ਰਹਿੰਦੀ ਹੈ ਅਤੇ ਇਨਵੈ ਇੱਥੇ ਲੋਕਾਂ ਕੋਲ ਇਨਵੈਟਰ ਹਨ ਇਸ ਕਰਕੇ ਸਾਨੂੰ ਇਨਵੈਟਰ ਨਾਲ ਹੀ ਕੰਮ ਚਲਾਉਣਾ ਪੈਂਦਾ ਹੈ